ਹੈਲੋ ਮੈਮ ਮੂਨ ਕਲੱਬ ਤੋਂ ਬੋਲਦੇ ਤੁਸੀਂ ਮੈਮ ਮੈਂਨੇ ਐਡਵਰਟਾਇਜਮੇਂਟ ਦੇਖੀ ਸੀ ਅਸਲ 'ਚ ਮੈਮ ਸਮਰ ਵਿਕੇਸ਼ਨ ਚੱਲ ਰਹੇ ਨੇ ਨਾ ਤਾਂ ਮੈਂਨੇ ਆਪਦੇ ਬੱਚੇ ਦੀ ਐਡਮੀਸ਼ਨ ਕਰਵਾਉਣੀ ਸੀ ਤੁਹਾਡੇ ਕਲੱਬ 'ਚ ਜਾਣਨਾ ਚਾਹੁੰਦੀ ਹਾਂ ਵਈ ਕੀ ਕੀ ਸਕਿੱਲਜ਼ ਸਿਖਾਉਂਦੇ ਹੋ ਮਤਲਬ ਤੁਸੀਂ ਆਪਦੇ ਕਲੱਬ 'ਚ

ਓਕੇ ਮੈਮ ਫੇਰ ਸੇਫ਼ਟੀ ਬੱਚਿਆਂ ਦੀ ਪੂਰੀ ਹੈ ਨਾ ਸੇਫ਼ਟੀ ਵਗੈਰਾ ਪੂਰੀ ਹੈ ਮੈਮ ਬੱਚਿਆਂ ਦੀ ਓਕੇ ਮੈਮ ਓਕੇ ਅਤੇ ਮੈਮ ਫਿਰ ਬੱਸ ਵਗੈਰਾ ਦੀ ਸਰਵਿਸ ਹੈਗੀ ਹੈ ਮਤਲਬ ਤੁਸੀਂ ਖੁਦ ਪਿਕਅੱਪ ਕਰਦੇ ਹੋ ਕਿ ਮਤਲਬ ਸਾਨੂੰ ਛੱਡ ਕੇ ਜਾਣਾ ਪਿਆ ਕਰੂ

ਓਕੇ ਮੈਮ ਅਤੇ ਫੀਸ ਵਗੈਰਾ ਕਿੰਨੀ ਹੈ ਮੈਮ ਮੈਮ ਪਰ ਮੰਥ ਓਕੇ ਮੈਮ ਓਕੇ ਓਕੇ ਮੈਮ ਦੱਸ ਦਿਆਂਗੇ ਤੁਹਾਡੇ ਨਾਲ ਕਨੈਕਟ ਕਰਦੇ ਹਾਂ ਥੈਂਕ ਯੂ ਮੈਮ